ਮੈਂ ਜਸਪ੍ਰੀਤ ਕੌਰ ਪਿੰਡ ਹੰਡਿਆਇਆ ਜ਼ਿਲ੍ਹਾ ਬਰਨਾਲਾ ਦੀ ਪੱਕੀ ਵਸ ਵਸਨੀਕ ਹਾਂ ਮੈਂ ਆਪਣੀ ਟੈਨਥ ਟੂ ਪਲਸ ਟੂ ਇੱਥੇ ਹੀ ਹੰਡਿਆਇਆ ਸਕੂਲ ਵਿੱਚ ਕੀਤੀ ਹੈ ਅਤੇ ਬੀ ਏ ਐਸਟੀ ਕਾਲਜ ਵਿੱਚ ਕੀਤੀ ਹੈ ਹੁਣ ਮੈਂ ਆਪਣਾ ਸਲੂਨ ਦਾ ਕੋਰਸ ਜੋ ਕਿ ਸੰਗਰੂਰ ਵਿਖੇ ਕਰ ਰਹੀ ਹਾਂ ਮੈਂ ਉੱਥੇ ਇੱਕ ਕਿਰਾਏ ਦੇ ਅਪਾਰਟਮੈਂਟ ਵਿੱਚ ਰਹਿਣ ਰਹਿ ਰਹੀ ਹਾਂ ਕਿਉਂਕਿ ਮੈਨੂੰ ਡੇਲੀ ਹੀ ਅੱਪ ਡਾਊਨ ਕਰਨ ਵਿੱਚ ਬਹੁਤ ਦਿੱਕਤ ਮਹਿਸੂਸ ਹੁੰਦੀ ਹੈ ਮੇਰੇ ਉੱਥੇ ਮੈਂ ਕਿਰਾਏ ਦੇ ਰੂਮ ਵਿੱਚ ਰਹਿ ਰਹੀ ਹਾਂ ਤਾਂ ਕਿ ਮੈਨੂੰ ਡੇਲੀ ਦੇ ਕਿਰਾਏ ਤੋਂ ਬੱਚ ਸਕਾਂ ਅਤੇ ਮੈਨੂੰ ਉੱਥੇ ਮੇਰੇ ਸਲੈ ਮੈਨੂੰ ਇੱਕ ਸਿਲੰਡਰ ਦੀ ਜ਼ਰੂਰਤ ਹੈ ਖਾਣਾ ਪਕਾਉਣ ਲਈ ਮੈਂ ਆਪਣਾ ਸਿਲੰਡਰ ਬੁੱਕ ਕਰਵਾਉਣਾ ਹੈ ਤਾਂ ਕਿ ਮੈਂ ਆਪਣਾ ਖਾਣਾ ਖੁਦ ਬਣਾ ਸਕਾਂ ਕਿਉਂਕਿ ਮੈਨੂੰ ਡੇਲੀ ਹੀ ਬਾਹਰ ਕੁਛ ਨਾ ਕੁਛ ਲੈ ਕੇ ਖਾਣਾ ਪੈਂਦਾ ਹੈ ਬਾਹਰ ਦੀਆਂ ਚੀਜ਼ਾਂ ਬਹੁਤ ਹੀ ਜ਼ਿਆਦਾ ਤਲੀਆਂ ਅਤੇ ਬਹੁਤ ਹੀ ਜ਼ਿਆਦਾ ਖਰਾਬ ਹੁੰਦੀਆਂ ਹਨ ਜਿਸ ਨਾਲ ਪੇਟ ਦੀ ਇਨਫੈਕਸ਼ਨ ਵਗੈਰਾ ਬਿਮਾਰੀਆਂ ਬਹੁਤ ਸਾਰੀਆਂ ਬਿਮਾਰੀਆਂ ਫੈਲਦੀਆਂ ਹਨ ਅਤੇ ਇਸ ਨਾਲ ਸਾਨੂੰ ਕਈ ਤਰ੍ਹਾਂ ਦੇ ਰੋਗ ਲੱਗ ਜਾਂਦੇ ਹਨ ਅਤੇ ਇਸ ਲਈ ਮੈਂ ਆਪਣਾ ਖਾਧਾ ਖਾਣਾ ਖੁਦ ਹੀ ਬਣਾ ਕੇ ਖਾਣਾ ਚਾਹੁੰਦੀ ਹਾਂ ਤਾਂ ਕਿ ਮੈਂ ਆਪਣੀ ਪਸੰਦ ਦਾ ਖਾਣਾ ਬਣਾ ਕੇ ਖਾ ਚੁੱਕਾਂ ਤਾਂ ਕਿ ਮੈਨੂੰ ਕਿਸੇ ਕੋਲੋਂ ਅ ਡੇਲੀ ਮੰਗਣ ਦੀ ਜ਼ਰੂਰਤ ਨਾ ਪਵੇ ਇਸ ਲਈ ਮੈਂ ਆਪਣਾ ਸਿਲੰਡਰ ਬੁੱਕ ਕਰਵਾਉਣਾ ਚਾਹੁੰਦੀ ਹਾਂ ਮੇਰੀ ਕ ਮੈਨੂੰ ਇੱਕ ਨਵਾਂ ਸਿਲੰਡਰ ਦਿੱਤਾ ਜਾਵੇ ਮੈਂ ਆਪਣੇ ਸਿਲੰਡਰ ਬ ਕਮਰੇ ਵਿੱਚ ਨਵੇਂ ਸਿਲੰਡਰ ਦੀ ਜ਼ਰੂਰਤ ਹੈ ਮੈਨੂੰ ਇਨਡੇਨ ਗੈਂਸ ਏਜੰਸੀ ਵੱਲੋਂ ਇੱਕ ਨਵਾਂ ਸਿਲੰਡਰ ਅ ਦਿੱਤਾ ਜਾਵੇ ਤਾਂ ਕਿ ਮੈਂ ਆਪਣਾ ਖਾਣਾ ਖੁਦ ਬਣਾ ਸਕਾਂ ਅਤੇ ਖੁਦ ਆਪਣੀ ਮਨ ਪਸੰਦ ਦੀ ਚੀਜ਼ ਬਣਾ ਕੇ ਖਾ ਸਕਾਂ ਤਾਂ ਜਲਦੀ ਤੋਂ ਪਲ ਬੇਨਤੀ ਹੈ ਕਿ ਮੈਨੂੰ ਤੁਰੰਤ ਜਲਦੀ ਤੋਂ ਜਲਦੀ ਮੇਰਾ ਸਿਲੰਡਰ ਬੁੱਕ ਕੀਤਾ ਹੋਇਆ ਸਿਲੰਡਰ ਮੈਨੂੰ ਜਲਦੀ ਤੋਂ ਜਲਦੀ ਦਿੱਤਾ ਜਾਵੇ ਤਾਂ ਕਿ ਮੈਂ ਆਪਣਾ ਖਾਣਾ ਖੁਦ ਬਣਾ ਸਕਾਂ